ਗਾਣੇ ਵਿੱਚ ਮੈਨੂੰ ਸੈਡ ਸੋਂਗ ਬਹੁਤ ਪਸੰਦ ਨੇ ਜਿਨ੍ਹਾਂ ਵਿੱਚੋਂ ਬੱਬੂ ਮਾਨ ਮੇਰਾ ਪਸੰਦੀਦਾ ਸੰਗੀਤਗਾਰ ਹੈ ਬੱਬੂ ਮਾਨ ਦੀ ਜਿਹੜੀ ਅਵਾਜ਼ ਹੈ ਉਹ ਬੜੀ ਸੁਰੀਲੀ ਜਿਹਨੂੰ ਅੰਗਰੇਜ਼ੀ ਵਿੱਚ ਮੈਲੋਡੀ ਕਿਹਾ ਜਾਂਦਾ ਹੈ ਉਹ ਹੈ ਜਿਹੜੀ ਕਿ ਦਿਲ ਨੂੰ ਸਕੂਨ ਦਿੰਦੀ ਹੈ ਜਿਹੜੇ ਸੈਡ ਸੌਗ ਨੇ ਪਤਾ ਨਹੀਂ ਕਿਉ ਮੇਰੇ ਪਸੰਦੀਦਾ ਹੋਣ ਕਰਕੇ ਮੈਨੂੰ ਇੱਕ ਮੇਰੇ ਇੱਕ ਦਿਲ ਨੂੰ ਸਕੂਨ ਜਿਹਾ ਦਿੰਦੇ ਨੇ ਇੱਕ ਦਿਮਾਗ ਨੂੰ ਜਿਹੜੀਆਂ ਟੈਨਸ਼ਨਾਂ ਨੇ ਉਹਨਾਂ ਤੋਂ ਰਾਹਤ ਮਿਲਦੀ ਆ ਅਤੇ ਇੱਕ ਸੁੱਖ ਜਿਹਾ ਮਿਲਦਾ ਹੈ ਜਿਸ ਤੋਂ ਮੈਨੂੰ ਇੱਕ ਹਰੇਕ ਕੰਮ ਕਰਨ ਦੀ ਇੱਕ ਪ੍ਰੇਰਨਾ ਜਿਹੀ ਮਿਲਦੀ ਹੈ ਕਿ ਮੈਂ ਇੱਕ ਸੂਝ ਬੂਝ ਸਹੀ ਤੰਦਰੁਸਤ ਹੋ ਜਾਂਦਾ ਹਾਂ